ਸਾਡੀ ਜ਼ਿੰਦਗੀ ਵਿੱਚ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਹਨ ਜਿਵੇਂ ਹੁਣ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਮਨੋਰੰਜਨ ਕਰ ਸਕਦੇ ਹਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਹੀ ਅਸੀਂ ਮਨੋਰੰਜਨ ਕਰ ਸਕਦੇ ਹਾਂ ਉਹਨਾਂ ਦੀਆਂ ਬਾਤਾਂ ਵਿੱਚ ਪੰਜਾਬ ਦੀ ਪੰਜਾਬੀਅਤ ਜਿਹੜੀ ਸਾਨੂੰ ਝਲਕਦੀ ਹੈ ਇਸ ਤਰ੍ਹਾਂ ਅਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਪੁਰਾਣੀਆਂ ਖੇਡਾਂ ਖੇਡ ਸਕਦੇ ਹਾਂ ਜਿਵੇਂ ਕਿ ਲੂਡੋ ਵਗੈਰਾ ਖੇਡਦੇ ਹਾਂ ਆਪਾਂ ਜਾਂ ਫਿਰ ਗੁੱਲੀ ਡੰਡਾ ਖੇਡਦੇ ਹਾਂ ਆਪਾਂ ਪੁਰਾਣਾ ਪੁਰਾਣੀਆਂ ਖੇਡਾਂ ਨੂੰ ਵੀ ਅਸੀਂ ਖੇਡ ਕੇ ਮਨੋਰੰਜਨ ਕਰ ਸਕਦੇ ਹਾਂ ਇਸ ਤਰ੍ਹਾਂ ਤਾਸ਼ ਵਗੈਰਾ ਖੇਡਦੇ ਹਾਂ ਅਤੇ ਆਪਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਬਾਤਾਂ ਬੁਝਾਰਤਾਂ ਸੁਣ ਕੇ ਅਸੀਂ ਆਪਣਾ ਮਨੋਰੰਜਨ ਕਰਦੇ ਹਾਂ ਕਿਉਂਕਿ ਉਹਨਾਂ ਦੀਆਂ ਗੱਲਾਂ ਵਿੱਚੋਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਵਿੱਚ ਸਾਨੂੰ ਬਹੁਤ ਸਾਰਾ ਉਹਨਾਂ ਦਾ ਤਜ਼ਰਬਾ ਦੇਖਣ ਨੂੰ ਮਿਲਦਾ ਹੈ ਅਤੇ ਉਹਨਾਂ ਦੀਆਂ ਗੱਲਾਂ ਸਾਨੂੰ ਹਮੇਸ਼ਾ ਸਿੱਖਿਆ ਵੱਲ ਲੈ ਕੇ ਜਾਂਦੀਆਂ ਹਨ ਇਸ ਲਈ ਅਸੀਂ ਆਪਣੇ ਪਰਿਵਾਰ ਨਾਲ ਬਹੁਤ ਸਾਰਾ ਮਨੋਰੰਜਨ ਕਰ ਸਕਦੇ ਹਾਂ ਕੋਈ ਖੇਡਾਂ ਖੇਡ ਕੇ ਬਹੁਤ ਸਾਰੀਆਂ ਕੁੜੀਆਂ ਮੁੰਡਿਆਂ ਮੁੰਡੇ ਪਹਿਲਾਂ ਇਕੱਠੀਆਂ ਖੇਡਾਂ ਖੇਡਦੇ ਸੀ ਅੱਜ ਕੱਲ ਇਹ ਰੁਝਾਨ ਘੱਟ ਗਿਆ ਹੈ ਅੱਜ ਕੱਲ ਬੱਚੇ ਜਿਹੜੇ ਉਹ ਆਪਣੇ ਇਕੱਲ ਇਕੱਲੇਪਣ ਵਿੱਚ ਰਹਿਣਾ ਜ਼ਿਆਦਾ ਖੁਸ਼ ਕਰ ਖੁਸ਼ ਇਕੱਲੇਪਣ ਵਿੱਚ ਜ਼ਿਆਦਾ ਖੁਸ਼ ਰਹਿੰਦੇ ਨੇ ਇਸ ਲਈ ਅੱਜ ਕੱਲ ਮਨੋਰੰਜਨ ਆ ਜਿਹੜਾ ਉਹ ਬੱਚੇ ਸਿਰਫ ਮੋਬਾਈਲਾਂ 'ਤੇ ਹੀ ਕਰਦੇ ਨੇ ਅਤੇ ਦੋਸਤਾਂ ਮਿੱਤਰਾਂ ਨਾਲ ਘੱਟ ਰਹਿਣਾ ਪਸੰਦ ਕਰਦੇ ਨੇ ਪਰ ਦੋਸਤਾਂ ਮਿੱਤਰਾਂ ਨਾਲ ਰਹਿਣ ਨਾਲ ਮਨੋਰੰਜਨ ਕਰਨਾ ਸਾਨੂੰ ਮਨੋਰੰਜਨ ਕਰਨਾ ਚਾਹੀਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਚਾਹੀਦੀਆਂ ਹਨ ਆਪਣਾ ਟਾਈਮ ਜਿਹੜਾ ਉਹਨਾਂ ਨਾਲ ਬਿਤਾਉਣਾ ਚਾਹੀਦਾ ਹੈ